ਤੁਹਾਨੂੰ ਕੀ ਲੱਗਦਾ ਹੈ ਕੀ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਸਾਹਮਣਾ ਕਰਨਾ ਪੈਂਦਾ ਹੈ ਕੁਸ਼ਚਨ ਮਾਰਕ ਕਾਰੋਬਾਰ ਸ਼ੁਰੂ ਕਰਨ ਲਈ ਆਰਥਿਕ ਮੁਸ਼ਕਲਾਂ ਜਿਹੜੀਆਂ ਹਨ ਕੁਸਚਨ ਮਾਰਕ ਵੱਡੇ ਕਾਰੋਬਾਰ ਵਿੱਚ ਸਰਟੀਫਿਕੇਸ਼ਨ ਕਿਵੇਂ ਕੀਤੀ ਜਾਂਦੀ ਹੈ ਕੋਸ਼ਚਨ ਮਾਰਕ